ਭੰਗੜਾ ਇੱਕ ਪ੍ਰਸਿੱਧ ਪੰਜਾਬੀ ਲੋਕ ਨਾਚ ਹੈ ਇਹ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ ਭੰਗੜਾ ਪੰਜਾਬ ਦੇ ਪ੍ਰਮੁੱਖ ਲੋਚਨਾਚਾਂ ਵਿੱਚੋਂ ਇੱਕ ਹੈ ਦੂਜਾ ਪ੍ਰਮੁੱਖ ਨਾਚ ਗਿੱਧਾ ਹੈ ਆਮ ਤੌਰ 'ਤੇ ਭੰਗੜਾ ਨੌਜਵਾਨ ਗੱਭਰੂ ਕਰਦੇ ਹਨ ਅਤੇ ਗਿੱਧਾ ਮੁਟਿਆਰਾਂ ਪਾਉਂਦੀਆਂ ਹਨ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਜਿਵੇਂ ਮੇਲੇ ਤਿਉਹਾਰ ਵਿਆਹ ਅਤੇ ਕਣਕ ਦੀ ਵਾਢੀ ਸਮੇਂ ਭਾਵ ਵਿਸਾਖੀ ਸਮੇਂ ਪਾਇਆ ਜਾਂਦਾ ਹੈ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤ ਭਾਗੀ ਪ੍ਰਾਚੀਨ ਹੈ ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰ ਪੱਛਮੀ ਗੁਜਰਾਤ ਸ ਸਿਆਲਕੋਟ ਵਿੱਚ ਜ਼ਿਆਦਾਤਰ ਪ੍ਰਚਲਿਤ ਹੈ ਪਹਿਲਾਂ ਇਸ ਦਾ ਸੰਬੰਧ ਵਿਸਾਖੀ ਸਮੇਂ ਕਣਕ ਦੀ ਵਾਢੀ ਨਾਲ ਸੀ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਸਨ ਭੰਗੜਾ ਇੱਕ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਭੰਗੜੇ ਦਾ ਪ੍ਰਮੁੱਖ ਨਾ ਸਾਜ ਹੈ ਭੰਗੜੇ ਦੇ ਕੁਝ ਆਮ ਤੌਰ 'ਤੇ ਸਟੈਪ ਝੂਮਰ ਨਾਚ ਗਿੱਧਾ ਆਦਿ ਹਨ ਭੰਗੜਾ ਬਹੁਤ ਹੀ ਪੂਰੇ ਅਤੇ ਪੰਜਾਬ ਵਿੱਚ ਪ੍ਰਸਿੱਧ ਹੈ ਗਿੱਧਾ ਮੁਟ ਗਿੱਧਾ ਦਾ ਮੁਟ ਗਿੱਧਾ ਮੁਟਿਆਰਾਂ ਪਾਉਂਦੀਆਂ ਹਨ ਅਤੇ ਇਹ ਵੀ ਬਹੁਤ ਪ੍ਰਸਿੱਧ ਹਨ ਭੰਗੜੇ ਦਾ ਆਕਰਸ਼ਨ ਦਿਖਾਉਣ ਲਈ ਆਕਰਸ਼ਿਕ ਪੌਸ਼ਾਕਾਂ ਪਹਿਨਣੀਆਂ ਚਾਹੀਦੀਆਂ ਹਨ ਜੋ ਕਿ ਭੰਗੜਾ ਪਾਉਣ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਤਣਾਅ ਵੀ ਠੀਕ ਰਹਿੰਦਾ ਹੈ ਜੋ ਕਿ ਦੇਖਣ ਵਾਲੇ ਨੂੰ ਵਧੀਆ ਅਤੇ ਆਕਰਸ਼ਿਕ ਲੱਗਦਾ ਹੈ ਭੰਗੜੇ ਨੂੰ ਆਕਰਸ਼ਿਤ ਵਿਖਾਉਣ ਲਈ ਨੌਜਵਾਨ ਤੁਰਲੇ ਵਾਲੀ ਪੱਗ ਕੁੜਤਾ ਚਾਦਰਾ ਕੱਛ ਕਛਮੀ ਜੁੱਤੀ ਅਤੇ ਪੈਂਡਾ ਆਦਿ ਪਹਿਨਦੇ ਹਨ ਜੋ ਕਿ ਉਸ ਭੰਗੜਾ ਦੇ ਲੋਕ ਗਿੱਧੇ ਹਨ ਜੋ ਦੇਖਣ ਵਾਲੇ ਵਿਅਕਤੀ ਨੂੰ ਵੱਧ ਲੱਗ ਸਕੇ ਇਸ ਕਰਕੇ ਭੰਗੜਾ ਪੰਜਾਬ ਦੀ ਬਹੁਤ ਹੀ ਪ੍ਰਸਿੱਧ ਨਾਚ ਹੈ ਇਹ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਇਹ ਇਕੱਲੇ ਪੰਜਾਬ ਵਿੱਚ ਹੀ ਨਹੀਂ ਪ੍ਰਚਲਿਤ ਸਗੋਂ ਦੁਨੀਆਂ ਭਰ ਵਿੱਚ ਵੀ ਮਨਾਇਆ ਜਾਂਦਾ ਹੈ